ਹੈਲੋ ਹਾਂਜੀ ਕਿਵੇਂ ਹੋ ਹਾਂਜੀ ਵਧੀਆ ਹੋਰ ਸਾਰੇ ਘਰੇ ਠੀਕ ਨੇ ਬੱਚੇ ਕਿਵੇਂ ਨੇ ਚਲੋ ਵਧੀਆ ਹੀ ਚਾਹੀਦਾ ਹੈਗਾ ਹੋਰ ਅੱਜ ਕੱਲ ਬੱਚੇ ਨੂੰ ਕਿੱਥੇ ਪੜਾ ਪੜਾ ਰਹੇ ਹੋ ਤੁਸੀਂ ਹਾਂਜੀ ਕਿਹੜੇ ਸਕੂਲ ਸਕੂਲ ਕਿਹੜਾ ਦੇਖਿਆ ਤੁਸੀਂ ਬੱਚੇ ਵਾਸਤੇ ਹਾਂਜੀ ਆਪਣੇ ਮੁਕਤਸਰ ਚ ਮੁਕਤਸਰ ਚ ਤਾਂ ਸ਼ਿਵਾਲਿਕ ਸਕੂਲ ਵੀ ਵਧੀਆ ਲਿਟਲ ਫਲਾਵਰ ਡੀ ਏ ਵੀ ਸਕੂਲ ਹੋ ਗਿਆ ਸੰਤ ਬਾਬਾ ਗੁਰਮੁਖ ਹੋ ਗਿਆ ਤੇ ਆਪਣਾ ਟੈਗੋਰ ਪਬਲਿਕ ਸਕੂਲ ਹੋ ਗਿਆ ਏ ਸ਼ਿਵਾਲਿਕ ਸ਼ਿਵੁਲਕ ਇਹ ਵਧੀਆ ਸਕੂਲ ਹੈਗੇ ਪੜਾਈ ਵਧੀਆ ਕਰਵਾਈ ਜਾਂਦੀ ਆ ਟੀਚਰ ਵਧੀਆ ਹੈਗੇ ਆ ਬੈਸਟ ਐ ਬਾਕੀ ਅੱਜ ਕੱਲ ਤਾਂ ਸਰਕਾਰੀ ਸਕੂਲ ਵੀ ਬਹੁਤ ਜਿਆਦਾ ਵਧੀਆ ਹੋ ਗਿਆ ਪੜ੍ਹਾਈ ਵਗੈਰਾ ਵਧੀਆ ਕਰਵਾਈ ਜਾਂਦੀ ਆ ਇੰਗਲਿਸ਼ ਮੀਡੀਅਮ ਹੋ ਗਿਆ ਖਾਣਾ ਪੀਣਾ ਦਿੰਦੇ ਹੈਗੇ ਆ ਵਰਦੀਆਂ ਵਗੈਰਾ ਸਭ ਫਰੀ ਦਿੰਦੇ ਆ ਹਾਂ ਅੱਠਵੀਂ ਤੱਕ ਤਾਂ ਮਤਲਬ ਖਾਣਾ ਦਿੰਦੇ ਆਗੇ ਤੇ ਵਰਦੀਆਂ ਵਗੈਰਾ ਵੀ ਦਿੰਦੇ ਆਗੇ ਬੱਚੇ ਨੂੰ ਹਰ ਚੀਜ਼ ਦਿੰਦੇ ਆ ਅੱਜ ਕੱਲ ਤਾਂ ਬੈਗ ਵੀ ਦੇਣ ਲੱਗ ਗਏ ਹਾਂ ਵਜ਼ੀਫਾ ਦਿੰਦੇ ਆ ਕੁੜੀਆਂ ਨੂੰ ਵਜ਼ੀਫਾ ਦਿੰਦੇ ਆਗੇ ਵਧੀਆ ਪੜਾਉਂਦੇ ਲਿਖਾਉਂਦੇ ਆ ਅੱਜ ਕੱਲ ਵੀ ਸਰ ਸਰਕਾਰੀ ਸਕੂਲ ਸਰਕਾਰੀ ਨਹੀਂ ਰਹਿ ਗਈ ਕਿ ਪ੍ਰਾਈਵੇਟ ਤਰ੍ਹਾਂ ਹੋ ਗਏ ਹੈਗੇ ਅੰਗਰੇਜ਼ੀ ਚੱਲਦੀ ਆ ਹਾਂਜੀ ਹਾਂਜੀ ਪਰ ਜਾਂ ਪ੍ਰਾਈਵੇਟ ਸਕੂਲਾਂ ਦੀ ਟੱਕਰ ਨਾ ਟੱਕਰ ਦੇ ਹਿਸਾਬ ਨਾਲ ਤਾਂ ਸਰਕਾਰੀ ਸਕੂਲ ਹੁਣ ਬੈਸਟ ਆ ਹਾਂ ਹਾਂ ਖਾਣਾ ਬਹੁਤ ਵਧੀਆ ਦਿੰਦੇ ਅੱਠਵੀਂ ਕਲਾਸ ਤੱਕ ਦਿੰਦੇ ਹੈਗੇ ਤੇ ਹਾਂ ਵਰਦੀਆਂ ਵੁਰਦੀਆਂ ਬੁੱਕਸ ਹੋ ਗਈ ਬੈਗ ਵਗੈਰਾ ਹੋ ਗਏ ਬੂਟ ਸ਼ੂਜ ਵਗੈਰਾ ਸਭ ਕੁਝ ਮਿਲਦਾ ਵਧੀਆ ਹੁੰਦੇ ਆ ਪੰਜਾਬੀ ਵਧੀਆ ਪੜਾਉਂਦੇ ਹੈਗੇ ਪੰਜਾਬੀ ਬਹੁਤ ਵਧੀਆ ਪੜਾਉਂਦੇ ਆ ਟੀਚਰ ਵੀ ਬਹੁਤ ਵਧੀਆ ਸਰਕਾਰੀ ਸਕੂਲ ਦੇ ਬੱਚਿਆਂ ਦੀ ਕੇਅਰ ਵਧੀਆ ਹੁੰਦੀ ਆ ਵੀ ਸਰਕਾਰੀ ਸਕੂਲ 'ਚ ਹਾਂਜੀ ਨਹੀਂ ਜੀ ਨਹੀਂ ਕੋਈ ਦਿੱਕਤ ਵਾਲੀ ਪ੍ਰੋਬਲਮ ਕੋਈ ਗੱਲ ਹੈ ਨਹੀਂ ਗੀ ਵੀ ਵਧੀਆ ਇਹ ਟੀਚਰ ਵੀ ਵਧੀਆ ਗੇ ਛੋਟੇ ਬੱਚੇ ਨੂੰ ਜਦੋਂ ਆਪਾਂ ਸਕੂਲ 'ਚ ਲਾਉਂਦੇ ਆ ਵਧੀਆ ਦੇਖਭਾਲ ਕਰਦੇ ਆ ਹਾਂਜੀ ਠੀਕ ਐ ਜੀ